ਜਦੋਂ ਅਸੀਂ ਤਰਨ ਤਾਰਨ ਇਲਾਕੇ ਵੱਲ ਜਾਂਦੇ ਹਾਂ ਇਲਾਕਿਆਂ ਵੱਲ ਜਾਂਦੇ ਹਾਂ ਤਾਂ ਉੱਥੇ ਮਾਝੀ ਭਾਸ਼ਾ ਬੋਲੀ ਜਾਂਦੀ ਹੈ ਉੱਥੇ ਮਾਝੀ ਭਾਸ਼ਾ ਬੋਲੀ ਜਾਂਦੀ ਹੈ ਜਿਸ ਦੀ ਅਸੀਂ ਸਮਝ ਆ ਜਾਂਦੀ ਹੈ ਉਹਨਾਂ ਨੂੰ ਸਾਡੀ ਸਮਝ ਆ ਜਾਂਦੀ ਹੈ ਅਤੇ ਸਾਨੂੰ ਉਹਨਾਂ ਦੀ ਸਮਝ ਆ ਜਾਂਦੀ ਹੈ ਜੇਕਰ ਕੋਈ ਸ਼ਬਦ ਔਖਾ ਲੱਗੇ ਤਾਂ ਇਹੋ ਜਿਹੇ ਇਨਸਾਨ ਹੁੰਦੇ ਹਨ ਜਿਹਨਾਂ ਨੂੰ ਸਾਡੀ ਅਤੇ ਉਹਨਾਂ ਦੀ ਦੋਨਾਂ ਦੀ ਸਮਝ ਆ ਜਾਂਦੀ ਹੈ ਅਤੇ ਅਸੀਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਅਤੇ ਕੋਈ ਸਾਨੂੰ ਕੋਈ ਔਖਾ ਨਹੀਂ ਲੱਗਦਾ ਉਹਨਾਂ ਦੀ ਬੋਲੀ ਅਤੇ ਸਾਡੀ ਬੋਲੀ ਵਿੱਚ ਕੋਈ ਅੰਤਰ ਨਹੀਂ ਪੰਜਾਬੀ ਭਾਸ਼ਾ ਹੀ ਉਹ ਬੋਲਦੇ ਹਨ ਪੰਜਾਬੀ ਅਸੀ ਬੋਲਦੇ ਹਾਂ ਪਰ ਥੋੜ੍ਹਾ ਜਿਹਾ ਉਹ ਸ਼ਬਦ ਕਈ ਵਾਰ ਕੋਈ ਚੀਜ਼ ਨੂੰ ਉਸ ਚੀਜ਼ ਨੂੰ ਉਹ ਹੋਰ ਸ਼ਬਦਾਂ ਨਾਲ ਬੋਲਦੇ ਹਨ ਅਤੇ ਅਸੀਂ ਹੋਰ ਸ਼ਬਦਾਂ ਨਾਲ ਬੋਲਦੇ ਹਾਂ ਜਦੋਂ ਐਸੇ ਇਨਸਾਨ ਜਿਹੜੇ ਸਮਝ ਰੱਖਦੇ ਹਨ ਉਹ ਸਾਨੂੰ ਦੱਸ ਦਿੰਦੇ ਹਨ ਤਾਂ ਸਾਨੂੰ ਕੋਈ ਔਖਾ ਨਹੀਂ ਲੱਗਦਾ ਇਹ ਬੋਲੀ ਤਕਰੀਬਨ ਅਲੱਗ ਚਾਰ ਜ਼ਿਲ੍ਹਿਆਂ ਬਾਅਦ ਥੋੜ੍ਹੀ ਮੋਟੀ ਫਰਕ ਸ਼ਬਦਾਂ ਦਾ ਫਰਕ ਪੈ ਜਾਂਦਾ ਹੈ ਪਰ ਸਾਨੂੰ ਸਮਝਣ ਵਿੱਚ ਕੋਈ ਔਖਿਆਈ ਨਹੀਂ ਆਉਂਦੀ ਪੰਜਾਬੀ ਭਾਸ਼ਾ ਕੋਈ ਔਖੀ ਨਹੀਂ ਸਮਝਣੀ ਪੰਜਾਬੀ ਭਾਸ਼ਾ ਬਹੁਤ ਸਰਲ ਹੈ ਅਤੇ ਸੌਖੀ ਹੈ ਇਹ ਸਾਰੇ ਦੇਸ਼ ਵਿੱਚ ਲਾਗੂ ਕਰਨੀ ਚਾਹੀਦੀ ਹੈ ਸਾਰੇ ਸਕੂਲਾਂ ਵਿੱਚ ਲਾਗੂ ਕਰਨੀ ਚਾਹੀਦੀ ਹੈ